ਸਤਿ ਸ਼੍ਰੀ ਅਕਾਲ ਮੈਮ ਹਾਂਜੀ ਮੈਮ ਹਾਂਜੀ ਮੈਮ ਹਾਂਜੀ ਮੈਮ ਮੈਂ ਦੱਸ ਸਕਦੀ ਹਾਂ ਹਾਂਜੀ ਮੈਮ ਪਹਿਲਾਂ ਮੈਨੂੰ ਤੁਸੀਂ ਆਪਣਾ ਚੈਨਲ ਦੱਸੋ ਕਿ ਮੈਂ ਸਬਸਕ੍ਰਾਈਬ ਕਰਾ ਤੁਹਾਨੂੰ ਅੱਛਾ ਵੈਸ਼ਾਲੀ ਮੈਮ ਅਤੇ ਮੈਮ ਤੇ ਬਹੁਤ ਸਾਰੀ ਦੁਕਾਨਾਂ ਪਠਾਨਕੋਟ 'ਚ ਅਤੇ ਜਿੱਦਾਂ ਕਿ ਜਮੈਟੋ ਸਵੀਗੀ ਦੇ ਮਤਲਬ ਕਿ ਘਰ ਹੀ ਡਿਲੀਵਰ ਕਰ ਜਾਂਦੇ ਆ ਹਾਂ ਜੇ ਤੁਸੀਂ ਜਾਣਾ ਵਾ ਕਿਤੇ ਮਤਲਬ ਕਿ ਆਪ ਅਤੇ ਓ ਸਵੀਗੀ ਵਗੈਰਾ 'ਤੇ ਉੱਥੇ ਤੁਸੀਂ ਜਾ ਸਕਦੇ ਹੋ ਉਹਦੇ ਤੁਹਾਨੂੰ ਉੱਥੇ ਤੁਸੀਂ ਜਾ ਸਕਦੇ ਹੋ ਸਟਾਰਬਕਸ ਵਗੈਰਾ ਵੀ ਜਾ ਸਕਦੇ ਹੋ ਹਾਂ ਅਤੇ ਅਸ ਸਟਾਰਬਕਸ 'ਤੇ ਕੋਫੀ ਦਾ ਤੁਹਾਨੂੰ ਪਤਾ ਹੀ ਹੋਏਗਾ ਹਾਂ ਉਹ ਬੜੀ ਫੇਮਸ ਆ

ਟਾਈਮਿੰਗ ਹੈ ਬਸ ਇਹਦੀ ਮਤਲਬ ਕਿ ਮੈਮ ਕੁਛ ਪਠਾਨਕੋਟ 'ਚ ਚੌਵੀ ਘੰਟੇ ਖੁੱਲ੍ਹੇ ਰਹਿੰਦੇ ਆ ਅਤੇ ਅਹ ਜਿਹੜੀ ਦਸ ਤੋਂ ਇੱਥੇ ਹੈਗਾ ਬਾਰਾਂ ਰਾਤੀਂ ਹਾਂਜੀ ਮੈਮ ਅਤੇ ਓਕੇ ਮੈਮ ਥੈਂਕ ਯੂ